ਉੱਨੀ ਜਨਵਰੀ ਦੋ ਹਜ਼ਾਰ ਪੰਦਰਾਂ ਵੀਹ ਫਰਵਰੀ ਦੋ ਹਜ਼ਾਰ ਸੌਲਾਂ ਪੰਦਰਾਂ ਮਾਰਚ ਦੋ ਹਜ਼ਾਰ ਅਠਾਰਾਂ ਛੱਬੀ ਫਰਵਰੀ ਦੋ ਹਜ਼ਾਰ ਵੀਹ ਪੰਦਰਾਂ ਅਗਸਤ ਦੋ ਹਜ਼ਾਰ ਇੱਕੀ